ਦੇਖੋ ਜੇਕਰ ਆਪਾਂ ਡਿਜੀਟਲ ਟਾਈਮ ਦੀ ਗੱਲ ਕਰੀਏ ਤਾਂ ਹਰ ਕੋਈ ਅੱਜ ਕੱਲ੍ਹ ਮੋਬਾਈਲ ਲੈਪਟੋਪ ਅਤੇ ਟਾਈਪ ਕਰਨਾ ਹੀ ਜ਼ਿਆਦਾ ਪਸੰਦ ਕਰਦਾ ਹੈ ਜਿਹੜੀ ਨਿਊ ਜਨਰੇਸ਼ਨ ਹੈ ਨਿਊ ਜਨਰੇਸ਼ਨ ਲਿਖਣਾ ਤਾਂ ਬਿਲਕੁਲ ਵੀ ਪਸੰਦ ਨਹੀਂ ਕਰ ਰਹੀ ਕੋਪੀ ਪੈੱਨ ਨਾਲ ਤਾਂ ਜਮਾਂ ਵੀ ਲਿਖਣਾ ਪਸੰਦ ਨਹੀਂ ਕਰ ਰਹੀ ਇਹਦੇ ਵਿੱਚ ਅਗਰ ਇਹਦਾ ਕਾਰਨ ਦੇਖਿਆ ਜਾਵੇ ਕਿ ਇਹ ਕਿਉਂ ਬਦਲਿਆ ਆ ਅਤੇ ਇਹਦੇ ਵਿੱਚ ਆਪਾਂ ਵੈਸਟਰਨ ਕਲਚਰ ਨੂੰ ਕਹਿ ਸਕਦੇ ਹਾਂ ਕਿ ਵੈਸਟਰਨ ਕਲਚਰ ਇੱਦਾਂ ਦਾ ਆ ਜਿੱਦਾਂ ਆਪਾਂ ਕੈਨੇਡਾ ਵਗੈਰਾ ਚਲੇ ਜਾਈਏ ਯੂ ਐੱਸ ਸਟੱਡੀ ਕਰਨ ਚਲੇ ਜਾਈਏ ਤਾਂ ਉੱਥੇ ਕੋਪੀ ਪੈੱਨ ਦਾ ਰਿਵਾਜ਼ ਹੈ ਹੀ ਨਹੀਂ ਕੋਪੀ ਪੈੱਨ ਆਪਣੇ ਇੱਧਰ ਜ਼ਿਆਦਾ ਚੱਲਦਾ ਹੈ ਉੱਧਰ ਤਾਂ ਲੈਪਟੋਪ 'ਤੇ ਸਟੱਡੀ ਹੈ ਸਾਰੀ ਸਾਰੀ ਦੀ ਸਾਰੀ ਸਟੱਡੀ ਜਿਹੜੀ ਹੈ ਔਨਲਾਈਨ ਹੈ ਤੋ ਜਿਹੜਾ ਸਾਰਾ ਲੈਪਟੋਪ ਮੋਬਾਈਲ ਤੋਂ ਹੀ ਬੱਚੇ ਉੱਥੇ ਪੜ੍ਹਦੇ ਹੈ ਇਹਦੇ ਕਰਕੇ ਆਪਣੇ ਇੱਧਰ ਵੀ ਇਹਦਾ ਕਾਫ਼ੀ ਅਸਰ ਜਿਹੜਾ ਉਹ ਆ ਗਿਆ ਕਾਫ਼ੀ ਕੁਛ ਦੇਖਣ ਨੂੰ ਬੱਚਿਆਂ 'ਚ ਮਿਲਦਾ ਹੈ ਅਤੇ ਬੱਚੇ ਚਾਹੁੰਦੇ ਹੈ ਕਿ ਲਿਖਣਾ ਤਾਂ ਪਏ ਹੀ ਨਾ ਸਿਰਫ਼ ਮੈਥ ਦੇ ਕੁਅਸਚਨ ਸੋਲਵ ਕਰਨ ਲਈ ਹੀ ਮੈਂ ਜਦੋਂ ਤੱਕ ਦੇਖਿਆ ਬੱਚੇ ਪੈੱਨ ਕੋਪੀ ਯੂਜ ਕਰਨਾ ਚਾਹੁੰਦੇ ਆ ਜਾਂ ਫਿਰ ਨੁਮੈਰੀਕਲ ਹੋ ਗਏ ਸਾਇੰਸ ਦੇ ਅਦਰਵਾਇਸ ਤਾਂ ਕੋਈ ਓ ਵਰਤਦਾ ਨਹੀਂ ਚਾਹੁੰਦਾ ਹੈਗਾ ਉਹਦਾ ਜਿਹੜਾ ਮੇਨ ਰੀਜਨ ਹੈ ਉਹ ਸਿਰਫ਼ ਮੈਨੂੰ ਇਹ ਵੀ ਲੱਗਦਾ ਕਿ ਜਿਹੜਾ ਵੈਸਟਰਨ ਕਲਚਰ ਹੈ ਉਹ ਜ਼ਿਆਦਾ ਅਪਣਾ ਰਹੇ ਲੋਕ ਔਰ ਉੱਧਰ ਹੀ ਇਹ ਚੀਜ਼ਾਂ ਹੈਗੀਆਂ ਆਪਣੇ ਤਾਂ ਜੇਕਰ ਗੱਲ ਕਰੀਏ ਤਾਂ ਸ਼ੁਰੂ ਤੋਂ ਕਾ ਕੋਪੀ ਪੈੱਨ ਹੀ ਚੱਲਦਾ ਆਇਆ ਬਟ ਜੋ ਜੋ ਅੱਗੋਂ ਵੈਸਟਰਨ ਕਲਚਰ ਬਾਹਰ ਦੇ ਲੋਕਾਂ ਵੱਲ ਰੁਝਾਨ ਵੱਧਦਾ ਜਾ ਰਿਹਾ ਉੱਧਰ ਦੀਆਂ ਚੀਜ਼ਾਂ ਨੂੰ ਲੋਕ ਅਪਣਾਉਂਦੇ ਜਾ ਰਹੇ ਹੈ ਉਹਦੇ ਕਰਕੇ ਜਿਹੜਾ ਆ ਉਹ ਪੈੱਨ ਕੋਪੀ ਤੋਂ ਜਿਹੜਾ ਮੋਬਾਈਲ 'ਤੇ ਟਾਈਪਿੰਗ ਜਿਹੜੀ ਹੈ ਉਹ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਸ਼ੁਕਰੀਆ ਥੈਂਕ ਊ